ਮੇਰਾ ਜਨਮਦਿਨ ਵੀਹ ਮਾਰਚ ਨੂੰ ਹੈ ਅਤੇ ਮੈਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਪਾਰਟੀ ਦਾ ਪ੍ਰਬੰਧ ਕਰਨਾ ਹੈ ਇਹ ਪਾਰਟੀ ਦਾ ਪ੍ਰਬੰਧ ਵੱਡੇ ਪੱਧਰ 'ਤੇ ਹੋਵੇਗਾ ਅਤੇ ਇਹ ਪਾਰਟੀ ਦਾ ਸ਼ਮਾ ਸਮਾਂ ਸ਼ਾਮ ਛੇ ਵਜੇ ਦਾ ਹੈ ਮੈਨੂੰ ਇਸ ਪਾਰਟੀ ਦੇ ਲਈ ਤਕਰੀਬਨ ਸੌ ਬੰਦਿਆਂ ਦੇ ਲਈ ਖਾਣਾ ਚਾਹੀਦਾ ਹੈ ਅਤੇ ਇਸ ਖਾਣੇ ਦੇ ਵਿੱਚ ਦਾਲ ਮੱਖਣੀ ਸ਼ਾਹੀ ਪਨੀਰ ਰਾਜਮਾਂਹ ਚਾਵਲ ਮਿੱਸੀ ਰੋਟੀਆਂ ਦਹੀਂ ਅਤੇ ਸਲਾਦ ਹੋਣਾ ਚਾਹੀਦਾ ਹੈ ਨਾਲ ਮਿੱਠੇ ਦੇ ਵਿੱਚ ਗੁਲਾਬ ਜਾਮਣ ਅਤੇ ਖੀਰ ਵੀ ਹੋਣੀ ਚਾਹੀਦੀ ਹੈ ਇਹ ਭੋਜਨ ਮੈਨੂੰ ਵੀਹ ਮਾਰਚ ਦੋ ਹਜ਼ਾਰ ਚੌਵੀ ਨੂੰ ਸ਼ਾਮ ਸਾਢੇ ਸੱਤ ਵਜੇ ਤੱਕ ਮੇਰੇ ਘਰ ਵਿਖੇ ਚਾਹੀਦਾ ਹੈ ਤੁਸੀਂ ਕਿਰਪਾ ਕਰਕੇ ਇਸ ਨੂੰ ਸਮੇਂ ਸਿਰ ਇਸ ਭੋਜਨ ਦੀ ਡਿਲੀਵਰੀ ਕਰੋ ਅਤੇ ਇਸ ਭੋਜਨ 'ਤੇ ਮੈਨੂੰ ਇਸ ਔਡਰ 'ਤੇ ਮੈਨੂੰ ਵਧੀਆ ਡਿਸਕਾਊਂਟ ਵੀ ਦੇਵੋ